ਵਿਦਿਆਰਥੀ ਦੂਜੇ ਕਸਬਿਆਂ ਦੇ ਜਦੋਂ ਸਕੂਲਾਂ ਜਾਂ ਹਾਈ ਸਕੂਲਾਂ ਦੇ ਵਿੱਚ ਆਉਂਦੇ ਹਨ ਤਾਂ ਉਹ ਸਾਈਕਲ ਜਾਂ ਫਿਰ ਪਿੰਡ ਦੀਆਂ ਲੋਕਲ ਬੱਸਾਂ ਵਿੱਚ ਆਉਂਦੇ ਹਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਰਾਇਆ ਬੱਸਾਂ ਦਾ ਬਹੁਤ ਜ਼ਿਆਦਾ ਹੁੰਦਾ ਅਤੇ ਇੱਥੇ ਕਈ ਵਾਰ ਨਿਯਮਤ ਬੱਸਾਂ ਵੀ ਨਹੀਂ ਚੱਲਦੀਆਂ ਅਤੇ ਬੱਚਿਆਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਅਤੇ ਜਿਹੜੀ ਪ੍ਰਾਇਮਰੀ ਸਕੂਲ ਦੇ ਵਿੱਚ ਸਿੱਖਿਆ ਹੈ ਉਹ ਤਾਂ ਫਿਰ ਵੀ ਚਲੋ ਵਧੀਆ ਹੈ ਪਰ ਜਿਹੜੀਆਂ ਚੁਣੌਤੀਆਂ ਉਹ ਸਾਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਗਰਮੀ ਹੁੰਦੀ ਤਾਂ ਬੱਚੇ ਚੱਕਰ ਖਾ ਕੇ ਗਿਰ ਜਾਂਦੇ ਨੇ ਕਈ ਵਾਰ ਬੱਸਾਂ ਨਹੀਂ ਮਿਲਦੀਆਂ ਕਾਫੀ ਚੁਣੌਤੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ